ਅਸੀਂ ਅਤੇ ਸਾਡਾ ਪਰਿਵਾਰ ਧਾਰਮਿਕ ਤਿਉਹਾਰ ਘਰ ਵਿੱਚ ਰਹਿ ਕੇ ਇੱਕ ਦੂਜੇ ਨਾਲ ਖੁਸ਼ੀਆਂ ਭਰ ਮਨਾਉਂਦੇ ਹਾਂ ਅਸੀਂ ਇਸ ਦੀ ਠਾਠ ਬਾਠ ਨਾਲ ਤਿਆਰੀਆਂ ਕਰਦੇ ਹਨ ਜਿਵੇਂ ਕਿ ਦੀਵਾਲੀ ਇਸ ਤਿਉਹਾਰ 'ਤੇ ਅਸੀਂ ਸਾਰੇ ਮਿਲ ਕੇ ਘਰ ਦੀ ਸਫਾਈਆਂ ਕਰਦੇ ਹਨ ਘਰ ਨੂੰ ਰੰਗ ਰੋਗਨ ਕਰਵਾਉਂਦੇ ਹਾਂ ਅਤੇ ਇੱਕ ਦੂਜੇ ਨੂੰ ਪਿਆਰ ਨਾਲ ਮਨਾਉਂਦੇ ਹਾਂ ਅਤੇ ਗਲਤੀਆਂ ਮੰਨਦੇ ਹਾਂ ਅਤੇ ਆਪਣੇ ਆਪ ਨੂੰ ਬਦਲਦੇ ਹਾਂ ਇਸ ਦਿਨ ਅਸੀਂ ਆਪਣੇ ਘਰ ਆਪਣੀ ਫੈਮਲੀ ਨਾਲ ਬੈਠ ਕੇ ਖਾਣਾ ਖਾਂਦੇ ਹਾਂ ਅਤੇ ਆਪਣੇ ਕਈ ਰਿਸ਼ਤੇਦਾਰਾਂ ਨੂੰ ਰੋਟੀ 'ਤੇ ਬੁਲਾਉਂਦੇ ਹਾਂ ਇਸ ਦੀ ਬੜੀ ਜੋਰ ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਇਸ ਦੇ ਨਾਲ ਨਾਲ ਹੋਰ ਵੀ ਕਈ ਤਿਉਹਾਰ ਹਨ ਜਿਵੇਂ ਕਿ ਲੋਹੜੀ ਇਸ ਦਿਨ ਅਸੀਂ ਸਾਰੇ ਭੈਣ ਭਰਾ ਮਿਲ ਕੇ ਇਕੱਠੇ ਪ ਪਤੰਗਬਾਜ਼ੀ ਕਰਦੇ ਹਾਂ ਅਤੇ ਇਸ ਦਿਨ ਅਸੀਂ ਇਕੱਠੇ ਕਿਤੇ ਘੁੰਮਣ ਫਿਰਨ ਜਾਂਦੇ ਹਾਂ ਅਤੇ ਬਾਹਰ ਦਾ ਖਾਣਾ ਖੂਬ ਖਾਂਦੇ ਹਾਂ